ਹੈਲੋ ਗੋਪਾਲ ਸਵੀਸਟ ਤੋਂ ਬੋਲ ਰਹੇ ਹੋ ਜੀ ਹਾਂਜੀ ਸਾਡੇ ਨਾ ਇੱਕ ਫੰਕਸ਼ਨ ਹੈ ਸ਼ਾਮੀ ਬਰਡੇ ਪਾਰਟੀ ਹੈ ਅਤੇ ਸਾਨੂੰ ਨਾ ਬਰਡੇ ਪਾਰਟੀ ਲਈ ਥੋੜ੍ਹਾ ਜਿਹਾ ਚਾਹੀਦਾ ਸਮਾਨ ਉਹਦੇ 'ਚ ਸਾਨੂੰ ਮਿਕਸ ਵੈੱਜ ਅਤੇ ਦਸ ਕੁ ਫੁਲਕੇ ਚਾਹੀਦੇ ਆ ਜੇ ਅਵੇਲੇਵਲ ਹੋ ਸਕਦੇ ਨੇ ਤਾਂ ਅਸੀਂ ਅੋਡਰ ਕਰ ਦੇਈਏ ਅਤੇ ਤੁਸੀਂ ਸਾਨੂੰ ਭਿਜਵਾ ਦਿਓ ਪਰ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਕਿ ਸਬਜ਼ੀ ਬਹੁਤੀ ਮਸਾਲੇਦਾਰ ਨਾ ਹੋਵੇ ਕਿਉਂਕਿ ਸਾਡੇ ਬਹੁਤੇ ਮਸਾਲੇ ਖਾਂਦੇ ਨਹੀਂ ਹੈਗੇ ਅਤੇ ਇਸਦੇ ਨਾਲ ਹੀ ਜੇ ਸਾਨੂੰ ਮਿਲ ਸਕਦੇ ਨੇ ਤਾਂ ਪਲੀਸ ਸਾਨੂੰ ਦੱਸ ਦਿਉ ਅਸੀਂ ਤੁਹਾਨੂੰ ਮੈਂ ਤੁਹਾਨੂੰ ਅਡਰੈੱਸ ਸੈਂਡ ਕਰ ਦਾਂਗੀ ਅਤੇ ਤੁਸੀਂ ਡਿਲਵਰੀ ਕਰ ਦਿਉ